ਜੀ ਹਾਂ ਸਾਡੇ ਖੇਤਰ ਵਿੱਚ ਬਹੁਤ ਸਾਰੇ ਸੈਲਾਨੀ ਆਉਂਦੇ ਨੇ ਦੌਰਿਆਂ 'ਤੇ ਘੁ ਆਉਂਦੇ ਨੇ ਉਹ ਦਰਬਾਰ ਸਾਹਿਬ ਸ਼੍ਰੀ ਤਰਨ ਤਾਰਨ ਸਾਹਿਬ ਜਾਂਦੇ ਨੇ ਉੱਥੇ ਬਹੁਤ ਸੋਹਣਾ ਵੱਡਾ ਸਾਰਾ ਸਰੋਵਰ ਬਣਿਆ ਹੋਇਆ ਲੋਕ ਦਰਸ਼ਨ ਕਰਦੇ ਨੇ ਸਰੋਵਰ ਵਿੱਚ ਇਸ਼ਨਾਨ ਪਾਣੀ ਕਰਦੇ ਨੇ ਇੱਕ ਝੂਲਣਾ ਮਹਿਲ ਗੁਰਦੁਆਰਾ ਵੀ ਬਣਿਆ ਹੋਇਆ ਹੈ ਉੱਥੇ ਵੀ ਲੋਕ ਆਪਣੀਆਂ ਪੁੱਤਰਾਂ ਦੀਆਂ ਦਾਤਾਂ ਲੈਣ ਲਈ ਆਪਣੀ ਉੱਥੇ ਸੁੱਖਨਾ ਲਾਹੁਣ ਵਾਸਤੇ ਵੀ ਆਉਂਦੇ ਨੇ ਬੀੜ ਬਾਬਾ ਬੁੱਢਾ ਸਾਹਿਬ ਜੀ ਆ ਉੱਥੇ ਪੁੱਤਰਾਂ ਦੀਆਂ ਦਾਤਾਂ ਲੈਣ ਵਾਸਤੇ ਵੀ ਆਉਂਦੇ ਆ ਸੰਗਤਾਂ ਆਉਂਦੀਆਂ ਨੇ ਸੈਲਾਨੀ ਆਉਂਦੇ ਦਰਸ਼ਨ ਮੇਲਿਆਂ ਵਾਸਤੇ ਆਉਂਦੇ ਨੇ ਇੱਕ ਸਾਡੇ ਲਾਗੇ ਸਰਾਂ ਵਾਂ ਉੱਥੇ ਅਦਾਲਤ ਬਣੀ ਹੋਈ ਹੈ ਲੋਕ ਪੁਰਾਣੀ ਪਿਛਲੇ ਪੁਰਾਣੇ ਰਿਵਾਜ ਦੀ ਬਣੀ ਹੋਈ ਛੋਟੀਆਂ ਇੱਟਾਂ ਦੀ ਉਹਨਾਂ ਨੂੰ ਵੀ ਜਿਹੜੇ ਬਾਹਰੋਂ ਸੈਲਾਨੀ ਘੁੰਮਣ ਆਉਣ ਉਹ ਆਉਣ ਕੇ ਵੇਖਦੇ ਨੇ ਅਤੇ ਆਪਣਾ ਮਨ ਪਰਚਾਵਾ ਕਰਦੇ ਨੇ ਹੋਰ ਇੱਥੇ ਇੱਕ ਇਹੋ ਜਿਹਾ ਕੁਛ ਬਣਾਇਆ ਜਾਣਾ ਚਾਹੀਦਾ ਤਰਨ ਤਾਰਨ ਵਿੱਚ ਕਿ ਜਿੱਥੇ ਸਾਰਾ ਕੁਛ ਸੱਭਿਆਚਾਰ ਬਾਰੇ ਅਤੇ ਧਾਰਮਿਕ ਸਾਰੀਆਂ ਚੀਜ਼ਾਂ ਬਾਰੇ ਦੱਸਿਆ ਹੋਵੇ ਅਤੇ ਸੈਲਾਨੀ ਜਿਹੜੇ ਆ ਉੱਥੇ ਇੱਕ ਜਗ੍ਹਾ 'ਤੇ ਹੀ ਵੇਖ ਸਕਣ ਅਤੇ ਮਨ ਖੁਸ਼ ਕਰ ਸਕਣ ਹੋਰ ਇੱਥੇ ਸਾਰੇ ਹੀ ਆਵਾਜਾਈ ਦੇ ਸਾਧਨ ਵੀ ਬਹੁਤ ਵਧੀਆ ਨੇ ਅਤੇ ਸਾਰੇ ਹੀ ਸੈਲਾਨੀ ਜਿਹੜੇ ਆ ਉਹ ਸੋਹਣੇ ਤਰੀਕੇ ਨਾਲ ਘੁੰਮ ਪਾਉਂਦੇ ਨੇ